ਟੈਕਨੋਲਜੀ ਅਤੇ ਇੰਟਰਨੈਟ ਦੇ ਵਧਣ ਨਾਲ ਹਰੇਕ ਵਿਅਕਤੀ ਦਾ ਦਾਇਰਾ ਕਾਫੀ ਵੱਧ ਗਿਆ ਹੈ ਹੁਣ ਕੋਈ ਵੀ ਵਿਅਕਤੀ ਆਪਣੀਆਂ ਨਿੱਜੀ ਜਾਂ ਵਪਾਰਿਕ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਸਿਰਫ਼ ਆਪਣੇ ਲੋਕਲ ਸਿਸਟਮ 'ਤੇ ਹੀ ਡਿਪੈਂਡ ਨਹੀਂ ਰਿਹਾ ਉਹ ਆਪਣੀ ਜ਼ਰੂਰਤਾਂ ਪਰ ਪੂਰੀਆਂ ਕਰਨ ਲਈ ਆਪਣੇ ਰਾਜ ਤੋਂ ਬਾਹਰ ਜਾਂ ਆਪਣੇ ਦੇਸ਼ ਤੋਂ ਬਾਹਰ ਤੱਕ ਵੀ ਪਹੁੰਚ ਕਰ ਸਕਦਾ ਹੈ ਇੰਟਰਨੈਟ ਦੇ ਵਧਣ ਦੇ ਨਾਲ ਹੁਣ ਅਸੀਂ ਦੂਰ ਦੂਰ ਬੈਠੇ ਆਪਣੇ ਸੱਜਣਾਂ ਮਿੱਤਰਾਂ ਜਾਂ ਰਿਸ਼ਤੇਦਾਰਾਂ ਜਾਂ ਵਪਾਰਿਕ ਸੰਸਥਾਵਾਂ ਨਾਲ ਤਾਲਮੇਲ ਬਣਾ ਸਕਦੇ ਹਾਂ ਅਤੇ ਟੈਕਨੋਲਜੀ ਦੇ ਵਧਣ ਦੇ ਨਾਲ ਹੁਣ ਆਉਣਾ ਜਾਣਾ ਬਹੁਤ ਅਸਾਨ ਹੋ ਚੁੱਕਿਆ ਹੈ ਜਿਸ ਦੇਸ਼ 'ਤੇ ਜਾਣ ਲਈ ਸਾਨੂੰ ਪੰਦਰਾਂ ਵੀਹ ਦਿਨ ਜਾਂ ਮਹੀਨਾ ਮਹੀਨਾ ਦਾ ਟਾਈਮ ਲੱਗਦਾ ਸੀ ਅੱਜ ਟੈਕਨੋਲੋਜੀ ਦੇ ਵਧਣ ਦੇ ਨਾਲ ਅਸੀਂ ਇੱਕ ਜਾਂ ਦੋ ਦਿਨ ਵਿੱਚ ਉਹ ਸਫ਼ਰ ਪੂਰਾ ਕਰ ਲੈਂਦੇ ਹਾਂ ਹੁਣ ਹਰ ਇੱਕ ਦੇਸ਼ ਵਿੱਚ ਅਲੱਗ ਅਲੱਗ ਲੈਂਗੁਏਜ ਹੈ ਹਰ ਸਟੇਟ ਦੇ ਵਿੱਚ ਅਲੱਗ ਅਲੱਗ ਲੈਂਗੁਏਜ ਹੈ ਪੰਜਾਬੀ ਭਾਸ਼ਾ ਸਿਰਫ਼ ਪੰਜਾਬ ਵਿੱਚ ਜਾਂ ਗੁਆਂਢੀ ਇੱਕ ਦੋ ਸੂਬਿਆਂ ਵਿੱਚ ਹੀ ਬੋਲੀ ਜਾਂ ਸਮਝੀ ਜਾ ਸਕਦੀ ਹੈ ਜਦੋਂ ਵਿਅਕਤੀ ਨੂੰ ਕਿਸੇ ਦੂਜੇ ਰਾਜ ਜਾਂ ਦੂਜੇ ਦੇਸ਼ ਦੇ ਨਾਲ ਸੰਪਰਕ ਕਰਨਾ ਹੁੰਦਾ ਹੈ ਤਾਂ ਉਸਨੂੰ ਇੰਗਲਿਸ਼ ਭਾਸ਼ਾ ਦੀ ਜ਼ਿਆਦਾ ਜ਼ਰੂਰਤ ਪੈਂਦੀ ਹੈ ਇਸ ਕਰਕੇ ਪੰਜਾਬੀ ਦੇ ਬਦਲਾਅ ਦੇ ਵਿੱਚ ਇੰਗਲਿਸ਼ ਭਾਸ਼ਾ ਜ਼ਿਆਦਾ ਜ਼ਰੂਰਤ ਅਨੁਸਾਰ